ਹਾਂਜੀ ਅਸੀਂ ਰੈਸਿਪੀ ਦੀ ਪਾਲਣਾ ਕਰਦੇ ਹਾਂ ਰੈਸਿਪੀ ਅਨੁਸਾਰ ਹੀ ਅਸੀਂ ਡਿਸ਼ ਬਣਾਉਂਦੇ ਹਾਂ ਅਤੇ ਸੁਆਦ ਡਿਸ਼ ਸੁਆਦ ਵੀ ਬਣਦੀ ਹੈ ਅਤੇ ਹਾਂ ਦੂਜਿਆਂ ਦੇ ਦੂਜਿਆਂ ਦੇ ਸੁਆਦ ਦੇ ਆਧਾਰ 'ਤੇ ਵੀ ਅਸੀਂ ਇੰਪਰੂਵਮੈਂਟ ਕਰਦੇ ਹਾਂ ਕਿਉਂਕਿ ਅਸੀਂ ਫੈਮਲੀ ਦੇ ਵਿੱਚ ਰਹਿੰਦੇ ਹਾਂ ਅਤੇ ਸਭ ਦੀ ਡਿਮਾਂਡ ਦਾ ਧਿਆਨ ਰੱਖਣਾ ਪੈਂਦਾ ਹੈ ਕਿਸੇ ਨੂੰ ਕੋਈ ਕਿਵੇਂ ਦੀ ਚੀਜ਼ ਪਸੰਦ ਹੈ ਅਤੇ ਕਿਸੇ ਨੂੰ ਕਿਵੇਂ ਦੀ ਚੀਜ਼ ਜਿਸ ਜਿਸ ਤਰ੍ਹਾਂ ਸੁਆਦ ਅਨੁਸਾਰ ਕੋਈ ਵੀ ਡਿਸ਼ ਮੰਗਦਾ ਹੈ ਉਹਨਾਂ ਨੂੰ ਅਸੀਂ ਵਧੀਆ ਡਿਸ਼ ਤਿਆਰ ਕਰਕੇ ਦਿੰਦੇ ਹਾਂ ਜਿਵੇਂ ਕੋਈ ਜ਼ਿਆਦਾ ਖਾਂਦਾ ਹੈ ਅਤੇ ਕੋਈ ਘੱਟ ਖਾਂਦਾ ਹੈ ਕੋਈ ਮਸਾਲਿਆਂ ਵਾਲੀਆਂ ਖਾਂਦਾ ਹੈ ਕੋਈ ਬਿਨਾਂ ਮਸਾਲੇ ਤੋਂ ਖਾਂਦਾ ਹੈ

ਕਈਆਂ ਦਾ ਬੀ ਪੀ ਹਾਈ ਹੋ ਜਾਂਦਾ ਹੈ ਮਸਾਲੇ ਵਾਲੀਆਂ ਮਸਾਲੇ ਵਾਲੀਆਂ ਡਿਸ਼ ਡਿਸ਼ਿਸ ਖਾ ਕੇ ਅਸੀਂ ਬਿਨਾਂ ਵਾਲੇ ਬਿਨਾਂ ਮਸਾਲੇ ਵਾਲੀਆਂ ਡਿਸ਼ ਖਾਣਾ ਪਸੰਦ ਕਰਦੇ ਹਾਂ ਇਸ ਲਈ ਸਾਨੂੰ ਉਹੋ ਜਿਹੀ ਡਿਸ਼ ਬਣਾਉਣੀ ਵਧੀਆ ਲੱਗਦੀ ਹੈ ਤਾਂ ਜੋ ਖਾਣ ਵਾਲੇ ਨੂੰ ਪਸੰਦ ਆ ਸਕ ਆ ਸਕੇ ਅਤੇ ਖੁਸ਼ ਹੋ ਕੇ ਆਨੰਦ ਨਾਲ ਖਾ ਸਕੇ ਬਹੁਤ ਜ਼ਿਆਦਾ ਸੁਧਾਰ ਵੀ ਹੋ ਗਏ ਹਨ ਅਤੇ ਜੇਕਰ ਕੋਈ ਚੀਜ਼ ਬਣਾਉਣੀ ਹੁੰਦੀ ਹੈ ਤਾਂ ਅਸੀਂ ਯੂਟਿਊਬ ਦੀ ਮਦਦ ਨਾਲ ਮਦਦ ਦੇ ਨਾਲ ਅਸੀਂ ਕੋਈ ਵੀ ਰੈਸਿਪੀ ਦੇਖਣੀ ਹੋਵੇ ਅਸੀਂ ਯੂਟਿਊਬ ਦੀ ਮਦਦ ਨਾਲ ਦੇਖ ਸਕਦੇ ਹਾਂ ਅਤੇ ਯੂਟਿਊਬ ਤੋਂ ਅਸੀਂ ਵਧੀਆ ਤਰੀਕੇ ਦੇ ਨਾਲ ਆਪਣੀ ਰੈਸਿਪੀ ਤਿਆਰ ਕਰ ਲੈਂਦੇ ਹਾਂ ਅਤੇ ਬਹੁਤ ਵਧੀਆ ਤਰੀਕੇ ਨਾਲ ਬਣਦੀ ਵੀ ਹੈ ਟੇਸਟਦਾਰ ਅਤੇ ਸੁਆਦ ਵਧੀਆ ਬਣਦੀ ਹੈ